ਕਿਰਤ ਕਰਨੀ ਨਾਮ ਵੰਡ ਛੱਕਣਾ ਨਾਮ ਜਪਣਾ ਇਹਨਾਂ ਤਿੰਨ ਮੂਲ ਸ਼ਬਦ ਜੋ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤੇ ਹਨ ਸਾਡੀ ਸੱਭਿਆਚਾਰਕ ਪਛਾਣ ਨੂੰ ਆਕਾਰ ਦਿੱਤਾ ਹੈ ਅਤੇ ਅਸੀਂ ਜੋ ਪ੍ਰੇਰਨਾਦਾਇਕ ਸ਼ਖਸ਼ੀਅਤ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਹੈ ਜਿਹਨਾਂ ਨੇ ਤੇਰ੍ਹਾਂ ਅਪ੍ਰੈਲ ਸੋਲਾਂ ਸੌ ਨੜ੍ਹਿਨਵੇਂ ਈਸਵੀ ਨੂੰ ਸ ਖਾਲਸਾ ਪੰਥ ਦੀ ਸਾਜਨਾ ਕੀਤੀ ਉਹਨਾਂ ਨੇ ਉਸ ਦਿਨ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਉਹਨਾਂ ਪੰਜ ਸਿਰਾਂ ਨੂੰ ਧਰਮ ਸਿੰਘ ਮੋਹਕਮ ਸਿੰਘ ਸਾਹਿਬ ਸਿੰਘ ਅਤੇ ਦਇਆ ਸਿੰਘ ਨੇ ਆਪਣੇ ਸੀਸ ਦੇ ਕੇ ਪੰਜ ਪਿਆਰੇ ਪਿਆਰਿਆਂ ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਸਾਡੀ ਸਾਨੂੰ ਉਹਨਾਂ ਨੇ ਪੰਜ ਕਕਾਰ ਦਿੱਤੇ ਕੇਸ ਕੰਘਾ ਕੜਾ ਕਿਰਪਾਨ ਅਤੇ ਕਛਹਿਰਾ ਅਤੇ ਉਹਨਾਂ ਨੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਆਪਣੇ ਚਾਰ ਪੁੱਤਰ ਸ਼੍ਰੀ ਚਮਕੌਰ ਸਾਹਿਬ ਵਿੱਚ ਵਾਰ ਦਿੱਤੇ ਅਤੇ ਉਹਨਾਂ ਨੇ ਮੁੱਖ ਵਿੱਚੋਂ ਸੀ ਤੱਕ ਨਹੀਂ ਕੀਤਾ ਅਤੇ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਹਿੰਦੂਆਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਵਾਰ ਦਿੱਤਾ ਅਤੇ ਉਹਨਾਂ ਦਾ ਸੀਸ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਅਤੇ ਉਹਨਾਂ ਨੂੰ ਰੰਗਰੇਟਾ ਗੁਰੂ ਕਾ ਬੇਟੇ ਦਾ ਖਿਤਾਬ ਦਿੱਤਾ ਅਤੇ ਉਹਨਾਂ ਨੇ ਉਹਨਾਂ ਸ਼ੂਦਰ ਕੌਮਾਂ ਜੋ ਕਿ ਮ ਮਾੜੀਆਂ ਸਮਝੀਆਂ ਜਾਂਦੀਆਂ ਉਹਨਾਂ ਨੂੰ ਗਲੇ ਲਗਾ ਕੇ ਅਤੇ ਇੱਕ ਨਵਾਂ ਖਿਤਾਬ ਦਿੱਤਾ ਰੰਗਰੇਟਾ ਗੁਰੂ ਕਾ ਬੇਟਾ ਅਤੇ ਉਹਨਾਂ ਨੇ ਅਜਿਹੀਆਂ ਹੋਰ ਘਟਨਾਵਾਂ ਵੀ ਦਿੱਤੀਆਂ ਜਿਸ ਦੇ ਉੱਤੇ ਸਾਨੂੰ ਮਾਣ ਹੈ